ਮੇਰੇ ਖਿਆਲ ਦੇ ਵਿੱਚ ਭਵਿੱਖ ਵਿੱਚ ਵਿਕਾਸ ਅਤੇ ਸਫ਼ਲਤਾ ਦੇ ਲਈ ਏ ਆਈ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਕੰਪਿਊਟਰ ਅਤੇ ਸਾਇੰਸ ਨਾਲ ਸੰਬੰਧਿਤ ਸੇਵਾਵਾਂ ਅਤੇ ਉਤਪਾਦਾਂ ਦੇ ਬਹੁਤ ਜ਼ਿਆਦਾ ਜ਼ਰੂਰਤ ਅਤੇ ਇਸ ਦੀ ਮੈਨਫੈਕਚਰਿੰਗ ਔਰ ਇਸਦੀ ਟ੍ਰੇਡਿੰਗ ਦੇ ਵਿੱਚ ਬਹੁਤ ਹੀ ਵੱਧ ਸੰਭਾਵਨਾਵਾਂ ਹਨ ਇਸ ਲਈ ਇਹਦੇ ਵੱਲ ਬਹੁਤ ਹੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ